ਹੈਲੋ ਸਰ ਸਤਿ ਸ਼੍ਰੀ ਅਕਾਲ ਸਰ ਕਮਿਊਨਿਟੀ ਇਕ ਬਹੁਤ ਚੰਗਾ ਸ਼ਬਦ ਆ ਵੀ ਸਾਰੇ ਧਰਮ ਵਿੱਚ ਭਾਈਚਾਰਾ ਹੋਣਾ ਬਹੁਤ ਜ਼ਰੂਰੀ ਹੈ ਵੀ ਸੰਵਿਧਾਨ ਨੇ ਸਾਨੂੰ ਇੱਕ ਰਾਈਟ ਦਿੱਤਾ ਅਤੇ ਸਾਰੇ ਲੋਕ ਮਿਲ ਮਿਲ ਕੇ ਰਹਿਣ ਹੈ ਨਾ ਧਾਰਮਿਕ ਤੌਰ 'ਤੇ ਨਿਰਪੱਖ ਹੋਏ ਦੇਸ਼ ਸਾਡਾ ਵੀ ਇੱਕੋ ਹੀ ਰੰਗ ਰੂਪ ਜਾਂ ਕੋਈ ਰੰਗ ਰੂਪ ਦਾ ਕੋਈ ਜਾਤ ਪਾਤ ਦਾ ਕੋਈ ਵੀ ਭੇਦ ਭਾਵ ਨਾ ਕੀਤਾ ਜਾਵੇ ਸਾਰਿਆਂ ਨੂੰ ਪੜ੍ਹਨ ਦਾ ਵੀ ਸਾਰਿਆਂ ਨੂੰ ਪੜ੍ਹਨ ਦਾ ਵੀ ਇੰਤਜ਼ਾਮ ਹੋਵੇ ਅਤੇ ਕਿਸੇ ਵੀ ਧਰਮ ਦੇ ਆਧਾਰ 'ਤੇ ਵੀ ਕੋਈ ਭੇਦਭਾਵ ਨਾ ਕੀਤਾ ਜਾਵੇ ਵੀ ਛੋਟੀ ਜਾਤ ਤੋਂ ਵੀ ਉਹ ਵੱਡੀ ਜਾਤ ਵਿੱਚ ਵੀ ਉੱਥੇ ਨਹੀਂ ਪੜ੍ਹ ਸਕਦਾ ਵੀ ਉਹ ਉੱਥੇ ਨਹੀਂ ਪੜ੍ਹ ਸਕਦਾ ਵੀ ਗਰੀਬ ਬੰਦਾ ਵੀ ਜੱਟਾਂ ਵਾਲੇ ਗੁਰੂ ਘਰ ਵਿੱਚ ਨਹੀਂ ਜਾ ਸਕਦਾ ਵੀ ਕਈ ਪਿੰਡਾਂ ਵਿੱਚ ਵੀ ਐਵੇਂ ਹੁੰਦਾ ਹੈਗਾ ਵੀ ਜਿਹੜੇ ਛੋਟੀ ਕਾਸਟ ਹੈਗਾ ਇਨਸ ਛੋਟੀ ਕਾਸਟ ਦਾ ਇਨਸਾਨ ਆ ਵੀ ਉਹ ਵੱਡੀ ਕਾ ਵੀ ਜਨਰਲ ਸਿੱਖਾਂ ਦੇ ਹੋਰ ਗੁਰੂ ਘਰ ਵਿਚ ਨਹੀਂ ਜਾ ਸਕਦਾ ਆਪਣੇ ਦੇਸ਼ ਵਿਚ ਐਵੇਂ ਬਹੁਤ ਜ਼ਿਆਦਾ ਕੀਤਾ ਜਾਂਦਾ ਹੈਗਾ ਵੀ ਛੋਟੇ ਵੀ ਹਰ ਇੱਕ ਇਨਸਾਨ ਨੂੰ ਨਾ ਆਪਣੇ ਦੇਸ਼ ਵਿੱਚ ਜਾਤ ਦੇ ਅਧਾਰ 'ਤੇ ਦੇਖਿਆ ਜਾਂਦਾ ਹੈਗਾ ਵੀ ਉਹ ਉਹਨਾਂ ਦਾ ਵੀ ਉਹ ਉਹਨਾਂ ਦਾ ਮੁੰਡਾ ਹੈਗਾ ਮਜ਼੍ਹਬੀ ਸਿੱਖਾਂ ਦਾ ਮੁੰਡਾ ਉਹ ਰਮਦਾਸੀਆਂ ਦਾ ਮੁੰ ਉਹ ਜੱਟਾਂ ਦਾ ਮੁੰਡਾ ਅਤੇ ਵੀ ਉਹ ਮਿਸਤਰੀਆਂ ਦਾ ਮੁੰਡਾ ਜਾਂ ਕੁੜੀ ਆ ਹਰ ਇੱਕ ਇਨਸਾਨ ਨੂੰ ਐਂ ਹੀ ਦੇਖਿਆ ਜਾਂਦਾ ਹੈਗਾ ਪਹਿਲਾਂ ਵਾਲੇ ਸਮੇਂ ਵਿੱਚ ਜਦੋਂ ਵੀ ਆਪਾਂ ਪਿੱਛੇ ਜਾਨੇ ਹੈਗੇ ਆਪਣੇ ਮਹਾਰਾਜਾ ਵਿੱਚ ਸਮੇਂ ਵਿੱਚ ਵੀ ਜੇ ਕੋਈ ਵੱਡੀ ਕਾਸਟ ਦਾ ਵੀ ਇਨਸਾਨ ਆ ਵੱਡੀ ਕਾਸਟ ਦਾ ਮਹਾਰਾਜਾ ਲੰਘਦਾ ਸੀ ਛੋਟੀ ਜੇ ਕਾਸਟ ਦੇ ਉਹਨੂੰ ਵੇਖ ਵੀ ਲੈਂਦੇ ਸੀ ਤਾਂ ਉਹਨੂੰ ਜਿੰਦਾ ਸਾੜ ਦਿੰਦੇ ਸੀ ਆਪਣੇ ਉਸ ਟਾਈਮ ਵਿਚ ਆਹ ਕੁਛ ਕੀਤਾ ਜਾਂਦਾ ਸੀਗਾ ਪਰ ਉਹ ਉਸ ਪਰ ਹੁਣ ਦੇ ਟਾਈਮ ਵਿੱਚ ਉਸ ਨਾਲੋਂ ਚਲੋ ਮੰਨ ਲਓ ਵੀ ਘੱਟ ਕਰ ਰਹੇ ਆ ਪਰ ਕਰ ਤਾਂ ਰਹੇ ਆ ਨਾ ਓਨੇ ਹੀ ਸਾਡੇ ਪੰਜਾਬ ਦੇ ਲੋਕ ਇਹ ਭੇਦਭਾਵ ਕਰਦੇ ਆ ਵੀ ਛੋਟੀ ਜਾਤ ਦੇ ਇਨਸਾਨ ਨੂੰ ਛੋਟਾ ਹੀ ਸਮਝਿਆ ਜਾਂਦਾ ਵੀ ਉਹਨੂੰ ਵੱਡਾ ਨਹੀਂ ਸਮਝਿਆ ਜਾਂਦਾ ਕਿਉਂ ਇਹ ਇਸ ਕਰਕੇ ਕਿਉਂ ਹੋ ਰਿਹਾ ਵੀ ਆਪਣੇ ਲੋਕ ਆ ਜਿਹੜੇ ਆਪਦੇ ਆਪ ਨੂੰ ਉੱਚਾ ਉੱਚਾ ਸਮਝਦੇ ਵੀ ਅਸੀਂ ਉੱਚਾ ਵੀ ਇਹ ਸਾਡੇ ਤੋਂ ਛੋਟੇ ਆ ਵੀ ਇਹ ਸਾਡੇ ਨੀਚੇ ਕੰਮ ਕਰਨ ਨਾ ਕਿ ਸਾਡੇ ਤੋਂ ਉੱਪਰ ਉੱਠ ਕੇ ਵੀ ਸਾਡੇ ਬਰਾਬਰ ਕੰਮ ਕਰ ਸਕਣ ਹਾਂਜੀ ਸਰ ਆਹੀ ਕਾਰਨਾ ਕਰਕੇ ਜਾਤਾਂ ਪਾਤਾਂ ਕਰਕੇ ਝਗੜੇ ਪੈ ਰਹੇ ਹੈਗੇ ਹਾਂਜੀ ਸਰ ਹਾਂਜੀ ਸਰ ਹਾਂਜੀ ਹਾਂਜੀ ਆਪਾਂ ਸਕੂਲਾਂ ਕਾਲਜਾਂ ਵਿੱਚ ਵੇਖਦੇ ਹਾਂ ਸਰ ਵੀ ਜਦੋਂ ਵੀ ਜਦੋਂ ਕਿਸੇ ਮੁੰ ਜਦੋਂ ਵੀ ਕਿਸੇ ਜਵਾਕ ਜਾਂ ਕੁੜੀ ਨੂੰ ਨਾਮ ਲਿਆ ਜਾਂਦਾ ਤਾਂ ਲੋਕ ਉਹਨੂੰ ਉਹਦੀ ਜਾਤ ਦਾ ਨਾਮ ਲੈ ਕੇ ਬੁਲਾਉਂਦੇ ਆ ਨਾ ਕਿ ਉਹਦਾ ਆਪਦਾ ਖੁਦ ਦਾ ਨਾਮ ਲੈ ਕੇ ਬੁਲਾਉਂਦੇ ਆ ਉੱਥੇ ਜੇ ਕੋਈ ਛੋਟੀ ਜਾਤ ਦਾ ਮੁੰ ਜਵਾਕ ਆ ਤਾਂ ਉਹਨੂੰ ਉਹਦੀ ਜਾਤ ਦਾ ਨਾਮ ਲੈ ਕੇ ਬੁਲਾਇਆ ਜਾਂਦਾ ਵੀ ਉੱਥੇ ਉਹਨੂੰ ਛੋਟਾ ਦਿਖਾਇਆ ਜਾਂਦਾ ਵੀ ਭੇਦਭਾਵ ਕੀਤਾ ਜਾਂਦਾ ਜਦੋਂ ਵੀ ਕੋਈ ਲੜਾਈ ਝਗੜਾ ਹੁੰਦਾ ਵੀ ਤੂੰ ਉਹਨਾਂ ਦਾ ਮੁੰਡਾ ਤੂੰ ਉਹਨਾਂ ਦਾ ਮੁੰਡਾ ਇਹ ਕਾਫੀ ਭੇਦਭਾਵ ਕੀਤੇ ਜਾਂਦੇ ਹੈਗੇ ਆਪਣੇ ਪੰਜਾਬ ਵਿੱਚ ਦੇਸ਼ ਵਿੱਚ ਲੜਦੇ ਸਾਰੇ ਦੇਸ਼ ਵਿੱਚ ਕੀਤੇ ਜਾਂਦੇ ਆ ਪੰਜਾਬ ਦੀ ਗੱਲ ਕਿਉਂ ਕਰਦੇ ਹਾਂ ਆਪਾਂ ਪਰ ਜਦੋਂ ਆਪਾਂ ਕਿਸੇ ਫੋਰਨ ਕੰਟਰੀ ਵਿੱਚ ਜਾ ਵੜਦੇ ਹਾਂ ਉੱਥੇ ਕੋਈ ਭੇਦਭਾਵ ਦੇ ਉੱਤੇ ਸਾਰੇ ਹਿੰਦੂ ਸਿੱਖ ਮੁਸਲਿਮ ਇਸਾਈ ਸਾਰੇ ਇੱਕ ਹੋ ਜਾਂਦੇ ਆ ਕਿ ਬਰਾ ਹੁ ਬਾਹਰਲੇ ਕੰਟਰੀਆਂ 'ਚ ਜਾ ਕੇ ਕਿਉਂਕਿ ਉਹਨਾਂ ਨੂੰ ਇਹ ਆਪਣੇ ਜਾਤਾਂ ਪਾਤਾਂ ਤੋਂ ਕੋਈ ਭੇਦਭਾਵ ਨਹੀਂ ਕਰਦੇ ਉਹ ਸਾਰਿਆਂ ਨੂੰ ਇੱਕ ਸਮਾਨ ਸਮਝਦੇ ਆ ਹਾਂਜੀ ਸਰ ਹਾਂਜੀ ਸਰ ਆਪਣੇ ਦੱਸੋ ਇਹ ਵੀ ਕਿਹਾ ਜਾਂਦਾ ਵੀ ਜੇ ਕੋਈ ਸਿੱਖਾਂ ਦਾ ਮੁੰਡਾ ਮੁੰਡਾ ਜਾਂ ਕੁੜੀ ਮੁਸਲਿਮ ਦੇ ਉਹਦੇ ਵਿੱਚ ਗੁਰੂ ਦਰਬਾਰ 'ਚ ਜਾਂਦਾ ਇਹਦੇ 'ਚ ਜਾਂਦਾ ਉਹਨੂੰ ਵੀ ਮਾੜਾ ਸਮਝਿਆ ਜਾਂਦਾ ਵੀ ਤੂੰ ਉਹਨਾਂ ਦੇ ਉਹਨਾਂ ਦੇ ਵੀ ਧਰਮ ਵਿੱਚ ਕਿਉਂ ਗਿਆ ਹਾਂਜੀ ਸਰ ਹਾਂਜੀ ਸਰ ਆਪਣੇ ਵੀ ਅਤੇ ਕੁੜੀਆਂ ਮੁੰਡਿਆਂ ਵਿੱਚ ਬਹੁਤ ਫਰਕ ਕੀਤਾ ਜਾਂਦਾ ਚਲੋ ਕੁੜੀਆਂ ਮੁੰਡਿਆਂ ਵਿੱਚ ਫਰਕ ਕਰਨ ਵਾਲੀ ਤਾਂ ਆਪਾਂ ਇੱਕ ਅਲੱਗ ਗੱਲ ਕਰ ਰਹੇ ਹਾਂ ਪਰ ਇੱਥੇ ਸਾਡੇ ਦੇਸ਼ ਵਿੱਚ ਜਾਤਾਂ ਪਾਤਾਂ ਦੇ ਬਹੁਤ ਜ਼ਿਆਦਾ ਝਗੜੇ ਹੁੰਦੇ ਆ ਹਾਂਜੀ ਸਰ ਸਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੁਸੀਂ ਬੱਚੇ ਲਾ ਲਉ ਉਹਨਾਂ ਨੇ ਆਪਣਾ ਸਿੱਖ ਧਰਮ ਨੂੰ ਉਹਨਾਂ ਨੇ ਸਿੱਖ ਧਰਮ ਅਪਣਾਇਆ ਉਹਨਾਂ ਨੇ ਹਿੰਦੂ ਧਰਮ ਨਹੀਂ ਅਪਣਾਇਆ ਕਿਉਂਕਿ ਉਹ ਸਿੱਖ ਧਰਮ ਨੂੰ ਵੱਡਾ ਸਮਝਦੇ ਸੀ ਉਹ ਮੁਸਲਮਾਨ ਉਹਨਾਂ ਨੂੰ ਧੱਕੇ ਨਾਲ ਆਪ ਧਰਮ ਵਿੱਚ ਲਿਆਉਣਾ ਚਾਹੁੰਦੇ ਸੀ ਵੀ ਇਹ ਸਾਡਾ ਨਾਮ ਬੋਲਣ ਨਾ ਕਿ ਇਹ ਆਪ ਧਰਮ ਦਾ ਨਾਂ ਬੋਲਣ ਚਲੋ ਉਹਨਾਂ ਨੇ ਇਹ ਗੱਲ ਤੋਂ ਮਨਾ ਕਰਤਾ ਤਾਂ ਉਹਨਾਂ ਦਾ ਉਹਨਾਂ ਨੂੰ ਨੀਹਾਂ ਵਿੱਚ ਚਿਣਾਇਆ ਗਿਆ ਕਿਉਂਕਿ ਸਾਰੀ ਗੱਲ ਉੱਥੇ ਜਾਤ ਪਾਤ ਦੀ ਸੀ ਵੀ ਇਹ ਸਾਡਾ ਆਪਦਾ ਨਾਮ ਛੱਡ ਕੇ ਸਾਡਾ ਨਾਮ ਲੈਣ ਹਾਂਜੀ ਸਰ ਹਾਂਜੀ ਹਾਂਜੀ ਕਈ ਵਾਰ ਤਾਂ ਆਪਾਂ ਆਪਣੇ ਪਿੰਡਾਂ ਵਿੱਚ ਹੀ ਦੇਖਦੇ ਹਾਂ ਕਿ ਲੋਕ ਇੱਕ ਦੂਜਾ ਨਾਮ ਲੈ ਕੇ ਇੱਕ ਦੂਜੇ ਨੂੰ ਜਾਤਾਂ ਦਾ ਨਾਮ ਲੈ ਕੇ ਗਾਲੀ ਗਲੋਚ ਕਰਦੇ ਆ ਉੱਥੋਂ ਹੀ ਲੜਾਈ ਝਗੜੇ ਵੱਧ ਵੱਧਦੇ ਜਾਂਦੇ ਆ ਵੀ ਮੇਰੀ ਤਾਂ ਵੀ ਆਪਾਂ ਨੂੰ ਸਿਰਫ ਪੰਜਾਬ ਵਿੱਚ ਰਾਜ ਸਰਕਾਰ ਨੂੰ ਵੀ ਇਹੀ ਅਪੀਲ ਆ ਵੀ ਤੁਸੀਂ ਵੀ ਜਾਤ ਪਾਤ ਦੇ ਵੀ ਸਾਰਾ ਵੀ ਖਤਮ ਕੀਤਾ ਜਾਵੇ ਵੀ ਹਰ ਇੱਕ ਇਨਸਾਨ ਵਿੱਚ ਖੂਨ ਤਾਂ ਇੱਕ ਰੰਗ ਦਾ ਹੀ ਹੁੰਦਾ ਜਦੋਂ ਵੀ ਕਿਸੇ ਨੂੰ ਜ਼ਰੂਰਤ ਪੈਂਦੀ ਆ ਜਦੋਂ ਕਿਸੇ ਨੂੰ ਮਤਲਬ ਐਮਰਜੈਂਸੀ ਦੀ ਬਲੱਡ ਦੀ ਲੋੜ ਪਵੇ ਉਦੋਂ ਆਪਾਂ ਕੋਈ ਜਾਤ ਪਾਤ ਨਹੀਂ ਦੇਖਦੇ ਕਿਉਂ ਉਦੋਂ ਆਪਾਂ ਨੂੰ ਆਪਣੇ ਇਨਸਾਨ ਦੀ ਜਾਨ ਬਚਾਉਣਾ ਜ਼ਰੂਰੀ ਹੁੰਦਾ ਨਾ ਕਿ ਉੱਥੇ ਐਂ ਵੇਖਿਆ ਜਾਂਦਾ ਵੀ ਇਹ ਆਹ ਵਾਲੀ ਜਾਤ ਦਾ ਖੂਨ ਆ ਅਤੇ ਅਸੀਂ ਵੀ ਇਹ ਨਹੀਂ ਲੈਣਾ ਉਸ ਟਾਈਮ ਆਪਾਂ ਨੂੰ ਐਂ ਹੁੰਦਾ ਵੀ ਸਾਡੇ ਪੇਸ਼ੈਂਟ ਪੇਸ਼ੈਂਟ ਦੀ ਵੀ ਜਾਣ ਬਚ ਜੇ ਉਸ ਟਾਈਮ ਆਪਾਂ ਕਿਉਂ ਨਹੀਂ ਜਾਤਾਂ ਪਾਤਾਂ ਨੂੰ ਦੇਖਦੇ ਤੁਸੀਂ ਦੇਖਦੇ ਜਦੋਂ ਵੀ ਕਿਸੇ ਗੁਰੂ ਦਾ ਜਨਮ ਮਨਾਇਆ ਜਾਂਦਾ ਜਾਂ ਕੋਈ ਵੀ ਗੁਰਪੂਰਬ ਦਿਹਾੜਾ ਮਨਾਇਆ ਜਾਂਦਾ ਉਦੋਂ ਆਪਣਾ ਪੰਜਾਬ ਆਪਣਾ ਦੇਸ਼ ਵੰਡ ਰੱਖਿਆ ਇਹਨਾਂ ਨੇ ਆਪਦਾ ਧਰਮ ਵੰਡ ਰੱਖਿਆ ਵੀ ਜੇ ਕੋਈ ਉਹ ਮਜ਼੍ਹਬੀ ਸਿੱਖ ਆ ਤਾਂ ਉਹ ਆਪਦੇ ਗੁਰੂ ਦਾ ਮਨਾਉਣਗੇ ਜੇ ਕੋਈ ਮਜ ਰਾਮਦਾਸੀਏ ਸਿੱਖ ਆ ਉਹ ਬਾਬਾ ਰਵਿਦਾਸ ਦਾ ਮਨਾਉਣਗੇ ਜੇ ਕੋਈ ਮਿਸਤਰੀ ਸਿੱਖ ਆ ਅਤੇ ਉਹ ਆਪਣੇ ਦੂਜਾ ਆਪਦੇ ਬਾਬੇ ਦਾ ਮਨਾਉਣਗੇ ਫਿਰ ਉੱਥੇ ਵੀ ਐਂ ਵੇਖਿਆ ਜਾਂਦਾ ਵੀ ਕੌਣ ਸਾਡੇ ਆਇਆ ਸੀ ਅਸੀਂ ਉਹਨਾਂ ਦੇ ਧਰਮ 'ਚ ਜਾਣਾ ਜਾਂ ਨਹੀਂ ਜਾਣਾ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਤਾਂ ਸਿਰਫ ਇੱਕ ਗੱਲ ਹੀ ਕਹੀ ਹੈ ਵੀ ਪਰਮਾਤਮਾ ਇੱਕ ਆ ਮੇਰੀ ਰਾ ਪੰਜਾਬ ਸਰਕਾਰ ਵੱਲੋਂ ਆਹੀ ਅਪੀਲ ਆ ਵੀ ਇਹ ਧਰਮ ਸਾਰਾ ਕੁਛ ਵੀ ਖਤਮ ਕੀਤਾ ਜਾਵੇ ਵੀ ਲੋਕਾਂ ਨੂੰ ਵੀ ਇੱਕ ਬਣਾਇਆ ਜਾਵੇ ਵੀ ਐਂ ਅਪੀਲ ਕੀਤੀ ਜਾਵੇ ਵੀ ਕੋਈ ਇੱਥੇ ਹਿੰਦੂ ਮੁਸਲਿਮ ਕੋਈ ਸਿੱਖ ਨਹੀਂ ਵੀ ਸਾਰੇ ਸਿਰਫ ਇੱਕ ਹੀ ਆ ਅਤੇ ਗੁਰੂ ਨਾਨਕ ਦੇਵ ਜੀ ਵੀ ਕਹਿ ਗਏ ਨਾ ਕੋਈ ਹਿੰਦੂ ਨਾ ਕੋਈ ਸਿੱਖ ਇਸਾਈ ਸਾਂਝਾ ਭਾਈਚਾਰਾ ਵੀ ਸਰ ਮੈਂ ਸਰਕਾਰ ਵੱਲੋਂ ਬਸ ਮੇਰੀ ਇਹ ਹੈ ਇਹੀ ਅਪੀਲ ਆ ਵੀ ਸਾਰੇ ਇਹਨਾਂ ਵਿੱਚ ਜਾਤ ਪਾਤ ਦਾ ਤਾਂ ਨਾਮ ਖਤਮ ਕੀਤਾ ਜਾਵੇ ਅਤੇ ਇਹ ਖੁਸ਼ਹਾਲ ਅਤੇ ਸਾਨੂੰ ਬਰਾਬਰ ਸਮਝਿਆ ਜਾਵੇ ਥੈਂਕ ਯੂ ਸੋ ਮੱਚ ਸਰ